ਹੈਲੋ ਹੈਲੋ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੱਸੋ ਜੀ ਕਿਹੜੀ ਗੱਡੀ ਲੈਣੀ ਹੈ ਤੁਸੀਂ ਠੀਕ ਹੈ ਜੀ ਸਾਡੇ ਕੋਲ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਾਡੇ ਕੋਲ ਮੋਡਲ ਤੇਰ੍ਹਾਂ ਵਾਲਾ ਹੈਗਾ ਹੈ ਜੀ ਅਤੇ ਵਾਈਟ ਰੰਗ ਦੀ ਹੈਗੀ ਹੈ ਅਤੇ ਬਾਕੀ ਗੱਡੀ ਸਾਫ਼ ਹੈ ਬਿਲਕੁਲ ਹਾਂਜੀ ਜੀ ਜੀ ਜੀ ਏ ਸੀ ਵਾਲੀ ਗੱਡੀ ਹੈ ਜੀ ਹਾਂਜੀ ਜੀ ਜੀ ਏ ਸੀ ਬਿਲਕੁਲ ਠੀਕ ਠਾਕ ਹੈ ਹਾਂਜੀ ਹਾਂਜੀ ਟਾਇਰ ਵਧੀਆ ਹੈ ਜੀ ਅਤੇ ਹਾਂਜੀ ਇੰਜਣ ਵੀ ਵਧੀਆ ਅਤੇ ਟਾਇਰ ਟਾਇਰ ਬਿਲਕੁਲ ਸਹੀ ਹੈ ਤੁਸੀਂ ਕਲਰ ਜੀ ਚਿੱਟੇ ਰੰਗ ਦੀ ਹੈ ਵਾਈਟ ਕਲਰ ਦੀ ਹਾਂਜੀ ਹਾਂਜੀ ਜੇ ਹੋਰ ਕਲਰ ਹੈ ਤਾਂ ਹੋਰ ਕਲਰ ਵੀ ਹੈਗੇ ਸਾਡੇ ਕੋਲ ਠੀਕ ਹੈ ਜੀ ਤੁਸੀਂ ਕਿਹੜਾ ਮੋਡਲ ਲੈਣਾ ਹੈ ਜੀ ਅੱਛਾ ਜੀ ਹਾਂਜੀ ਸਤਾਰਾਂ ਵਾਲਾ ਵੀ ਦੋ ਹਜ਼ਾਰ ਅਤੇ ਤੇਰ੍ਹਾਂ ਵਾਲਾ ਵੀ ਹਾਂਜੀ ਇੰਜਣ ਵੀ ਠੀਕ ਹੈ ਬਰੇਕ ਵਗੈਰਾ ਸਾਰਾ ਕੁਛ ਸਹੀ ਹੈ ਏ ਸੀ ਵੀ ਠੀਕ ਚੱਲਦਾ ਹੈ ਅਤੇ ਗਾਣੇ ਵਗੈਰਾ ਮਿਊਜ਼ਿਕ ਵੀ ਹੈ ਉਹਦੇ ਵਿੱਚ ਹਾਂਜੀ ਜੀ ਇੰਨਸ਼ੋਅਰੈਂਸ ਵਗੈਰਾ ਸਾਰਾ ਕੁਛ ਹੋਇਆ ਹੋਇਆ ਜੀ ਤੁਸੀਂ ਹਾਂਜੀ ਹਾਂਜੀ ਹਾਂਜੀ ਅਤੇ ਤੁਸੀਂ ਹਾਂਜੀ ਚੈੱਕ ਕਰ ਲਿਉ ਹਾਂਜੀ ਜੀ ਅਤੇ ਮੋਡਲ ਨੇ ਹੈਗੇ ਹੈ ਜੀ